ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਤਰਨਜੀਤ ਸਿੰਘ ਹੈ ਜੀ ਮੈਂ ਪਿੰਡ ਟੱਪਰੀਆਂ ਦਾ ਰਹਿਣ ਵਾਲਾ ਜੀ ਅਸੀਂ ਅੰਮ੍ਰਿਤਸਰ ਜਾਣਾ ਚਾਹੁੰਦੇ ਜੀ ਉਹਦੇ ਲਈ ਤੁਹਾਡੀ ਕੈਬ ਬੁੱਕ ਕਰਨੀ ਹੈ ਜੀ ਅਤੇ ਪੰਦਰ੍ਹਾਂ ਤਰੀਕ ਨੂੰ ਅਸੀਂ ਜਾਣਾ ਹੈ ਜੀ ਸਵੇਰੇ ਦਸ ਵਜੇ ਸਾਨੂੰ ਤੁਸੀਂ ਸਾਡੇ ਘਰਾਂ ਚਾਹੀਦੇ ਹੈ ਜੀ ਅਤੇ ਅਸੀਂ ਅੰਮ੍ਰਿਤਸਰ ਵੀ ਜਾਣਾ ਹੈ ਜੀ ਅਤੇ ਨਾਲ਼ ਅਸੀਂ ਹੋਰ ਵੀ ਨੇੜਲੇ ਗੁਰਦੁਆਰਾ ਸਾਹਿਬ ਦੇਖਣੇ ਹੈ ਜਿਵੇਂ ਕਿ ਤਰਨਤਾਰਨ ਸਾਹਿਬ ਅਤੇ ਅਸੀਂ ਵਾਘਾ ਬਾਡਰ ਵੀ ਜਾਣਾ ਹੈ ਅਤੇ ਇੱਕ ਨਾਈਟ ਅਸੀਂ ਉੱਥੇ ਹੀ ਸਟੇਅ ਕਰਨੀ ਹੈ ਅਤੇ ਉੱਥੇ ਤੁਸੀਂ ਕਿੰਨਾਂ ਕਿਰਾਇਆ ਲਊਂਗੇ ਜੀ ਉੱਥੇ ਜਾਣ ਦਾ ਅਤੇ ਉਹ ਸਾਰਾ ਕੁਛ ਮੈਨੂੰ ਦੱਸਿਆ ਜਾਵੇ ਥੈਂਕ ਯੂ ਜੀ